ਹਾਂਜੀ ਅਸੀਂ ਨੌਜਵਾਨ ਪੀੜੀ ਨੂੰ ਖ਼ਬਰਾਂ ਦੀ ਪਾਲਣਾ ਕਰਨ ਲਈ ਬਹੁਤ ਉਤਸਾਹਿਤ ਕਰਦੇ ਹਾਂ ਜਿਵੇਂ ਕਿ ਆਪਣੇ ਹੁਣ ਦੇਸ਼ ਵਿੱਚ ਦੇਖ ਲਉ ਪੰਜਾਬ ਵਿੱਚ ਬਹੁਤ ਥਾਂ 'ਤੇ ਪਰਾਲੀ ਨੂੰ ਅੱਗ ਲਗਾਈ ਜਾਂਦੀ ਆ ਸਾਰੇ ਦੇਖਦੇ ਨੇ ਵੀ ਅੱਗ ਲਗਾਈ ਪਈ ਆ ਧੂੰਆਂ ਧੂੰਆਂ ਹੀ ਹੋਇਆ ਪਿਆ ਗਾ ਅਤੇ ਇਹਦੇ ਸਾਨੂੰ ਨੁਕਸਾਨ ਵੀ ਕਿੰਨੇ ਨੇ ਦੇਖੋ ਹੁਣ ਜੇ ਆਪਾਂ ਪਰਾਲੀ ਨੂੰ ਅੱਗ ਲਗਾਈਏ ਧੂੰਆਂ ਹੁੰਦਾ ਹੈ ਧੂੰਏਂ ਵਿੱਚੋਂ ਜਦੋਂ ਲੋਕ ਲੰਘਦੇ ਹੈ ਕਿਤੇ ਐਕਸੀਡੈਂਟ ਵੀ ਹੋ ਸਕਦਾ ਮੋਟਰਸੈਕਲ ਦੇ ਵਿੱਚ ਮੋਟਰਸੈਕਲ ਵੱਜਦਾ ਹੈ ਅਤੇ ਉਹ ਦੇਖੋ ਕਿੰਨਾ ਨੁਕਸਾਨ ਦਾਇਕ ਆ ਕਿਸੇ ਦੇ ਸੱਟ ਫੇਟ ਲੱਗਦੀ ਆ ਨੌਜਵਾਨਾਂ ਨੂੰ ਚਾਹੀਦਾ ਵੀ ਉਹ ਇਸ ਖ਼ਬਰ ਨੂੰ ਦਿਖਾਉਣ ਵੀ ਪਰਾਲੀ ਨੂੰ ਅੱਗ ਨਾ ਲਾ ਕੇ ਉਸਨੂੰ ਕੱਟ ਕੇ ਉਸਨੂੰ ਮਿੱਟੀ ਦੇ ਵਿੱਚ ਹੀ ਰਲਾਇਆ ਜਾਵੇ ਇਹਦੇ ਨਾਲ ਆਪਾਂ ਜਿਹੜਾ ਵਾਤਾਵਰਣ ਨਹੀਂ ਪ੍ਰਦੂਸ਼ਿਤ ਹੋਵੇਗਾ ਜੇ ਵਾਤਾਵਰਣ ਪ੍ਰਦੂਸ਼ਣ ਨਹੀਂ ਹੋਵੇਗਾ ਆਪਣੀ ਹਵਾ ਤਾਜ਼ੀ ਰਹੇਗੀ ਹਵਾ ਤਾਜ਼ੀ ਰਹੇਗੀ ਤਾਂ ਆਪਾਂ ਨੂੰ ਸਾਹ ਲੈਣ 'ਚ ਵੀ ਕੋਈ ਦਿੱਕਤ ਨਹੀਂ ਆਵੇਗੀ ਜੇ ਪਰਾਲੀ ਨੂੰ ਅੱਗ ਲੱਗੀ ਹੋਵੇਗੀ ਤਾਂ ਆਪਾਂ ਨੂੰ ਕਿੰਨੀ ਦਿੱਕਤ ਆਵੇਗੀ ਦੇਖੋ ਸਾਹ ਦੀਆਂ ਬਿਮਾਰੀਆਂ ਹੋਣਗੀਆਂ ਦਮਾ ਹੋਵੇਗਾ ਸਾਹ ਚੜ੍ਹੇਗਾ ਹੋਰ ਫਿਰ ਛੋਟੇ ਬੱਚਿਆਂ ਨੂੰ ਵੀ ਆਪਣੇ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ ਇਸ ਲਈ ਪਰਾਲੀ ਨੂੰ ਅੱਗ ਨਾ ਲਗਾ ਕੇ ਉਸਨੂੰ ਮਿੱਟੀ ਦੇ ਵਿੱਚ ਹੀ ਰੁਲਦ ਫੁਲਦ ਕਰਨਾ ਚਾਹੀਦਾ ਤਾਂ ਕਿ ਹਵਾ ਨੂੰ ਪ੍ਰਦੂਸ਼ਣ ਹੋਣ ਬਚਾਇਆ ਫਿਰ ਇੱਕ ਹੋਰ ਦੇਖੋ ਟਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਉਹ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਗਾ ਵੀ ਉਨ੍ਹਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਛੋਟੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਵੀ ਰੋਡ ਤੋਂ ਕਿਵੇਂ ਬੱਚੇ ਨੇ ਕ੍ਰੋਸ ਕਰਨਾ ਸੱਜੇ ਖੱਬੇ ਦੇਖ ਕੇ ਚੱਲਣਾ ਰੈਡ ਲਾਈਟ ਨੂੰ ਕ੍ਰੋਸ ਨਹੀਂ ਕਰਨਾ ਰੈਡ ਲਾਈਟ ਹੋਣ 'ਤੇ ਆਪਾਂ ਖੜ੍ਹਨਾ ਗਾ ਜੇ ਆਪਾਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਾਂਗੇ ਤਾਂ ਆਪਾਂ ਬਚੇ ਰਹਾਂਗੇ ਜੇ ਆਪਾਂ ਟਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਾਂਗੇ ਤਾਂ ਆਪਾਂ ਨੇ ਸੱਟ ਫੇਟ ਲੱਗ ਸਕਦੀ ਹੈ ਮੋਟਰਸਾਈਕਲ 'ਤੇ ਜਾਂਦੇ ਆਪਾਂ ਨੂੰ ਹੈਲਮਟ ਜ਼ਰੂਰ ਪਾਉਣਾ ਚਾਹੀਦਾ ਜੇ ਆਪਣੇ ਹੈਲਮਟ ਪਾਇਆ ਹੋਵੇ ਤਾਂ ਜੇ ਆਪਣੇ ਮੂਹਰੇ ਕੋਈ ਗੱਡੀ ਵਗੈਰਾ ਆਉਂਦੀ ਹੈ ਤਾਂ ਆਪਣਾ ਸਿਰ ਦੀ ਸੱਟ ਤੋਂ ਆਪਾਂ ਬਚ ਸਕਦੇ ਹਾਂ ਦੂਜੀ ਗੱਲ ਜਿਵੇਂ ਕਿ ਹੁਣ ਦੇਖ ਰਹੇ ਹਾਂ ਆਪਾਂ ਛੋਟੇ ਬੱਚੇ ਸੜਕ 'ਤੇ ਖੇਡਦੇ ਰਹਿੰਦੇ ਆ ਤਾਂ ਮਾਂ ਪਿਓ ਨੂੰ ਵੀ ਚਾਹੀਦਾ ਵੀ ਉਨ੍ਹਾਂ ਨੂੰ ਸੜਕ ਤੋਂ ਗੁਰੇਜ਼ ਕਰਨ ਖੇਡਣ ਤੋਂ ਤਾਂ ਕਿ ਉਨ੍ਹਾਂ ਨੂੰ ਕੋਈ ਨੁਕਸਾਨ ਨਾ ਹੋ ਸਕੇ ਬੱਚਿਆਂ ਨੂੰ ਚਾਹੀਦਾ ਵੀ ਉਹ ਆਪਣੇ ਟੀਚਰਾਂ ਤੋਂ ਸਮਝਣ ਵੀ ਸਾਨੂੰ ਕਿਵੇਂ ਅੱਗੇ ਮਤਲਬ ਕਿਵੇਂ ਅੱਗੇ ਆਪਾਂ ਨੂੰ ਰਸਤੇ 'ਤੇ ਜਾਣਾ ਚਾਹੀਦਾ ਗਾ ਠੀਕ ਹੈ